ਐਲ ਪੀ ਜੀ ਸਿਲੰਡਰ ਦੀ ਵਰਤੋਂ ਕਰਦੇ ਸਮੇਂ ਸਾਨੂੰ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈਗੀ ਜਿਵੇਂ ਆਪਾਂ ਨੂੰ ਜਿਹੜੀ ਉਹਦੀ ਪਾਈਪ ਹੁੰਦੀ ਹੈ ਨਾ ਉਹ ਆਪਾਂ ਨੂੰ ਬਾਰ ਬਾਰ ਜਾਂਚ ਕਰਦੇ ਰਹਿੰਦੇ ਹਾਂ ਅਤੇ ਹਰ ਪੰਜ ਸਾਲ ਬਾਅਦ ਆਪਾਂ ਨੂੰ ਉਹ ਬਦਲ ਲੈਣੀ ਚਾਹੀਦੀ ਹੈਗੀ ਅਤੇ ਜਿਵੇਂ ਆਪਾਂ ਰਾਤ ਨੂੰ ਜਦੋਂ ਆਪਣਾ ਰੋਟੀ ਦਾ ਨਾ ਰੋਟੀ ਪਾਣੀ ਦਾ ਕੰਮ ਨਿੱਬੜ ਜਾਂਦਾ ਤਾਂ ਉਦੋਂ ਕੀ ਆ ਰਾਤ ਨੂੰ ਚੁੱਲ੍ਹੇ ਨੂੰ ਬੰਦ ਕਰ ਦਿਓ ਹੈ ਨਾ ਚੁੱਲ੍ਹੇ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਉਹਦੇ ਬਟਨ ਹੁੰਦੇ ਆ ਜਿਹੜੇ ਅਤੇ ਉਹਨੂੰ ਰੈਗੂਲੇਟਰ ਤੋਂ ਬੰਦ ਕਰ ਦੇਣਾ ਚਾਹੀਦਾ ਅਤੇ ਜੇ ਮਤਲਬ ਕਿ ਹੈ ਨਾ ਕੋਈ ਅੱਗ ਵਾਲੀਆਂ ਚੀਜ਼ਾਂ ਆਪਣੇ ਸਿਲੰਡਰ ਦੇ ਕੋਲ ਪਈਆਂ ਤਾਂ ਉਹ ਦੂਰ ਕਰ ਦੇਣੀਆਂ ਚਾਹੀਦੀਆਂ ਨੇ ਜਿਵੇਂ ਮਾਚਿਸ ਲਾਈਟਰ ਵਗੈਰਾ ਹੋ ਗਿਆ ਇਹ ਸਾਰਾ ਇਹ ਸਭ ਚੀਜ਼ਾਂ ਨੇ ਜਿਹੜੀਆਂ ਦੂਰ ਰੱਖੋ ਹੈ ਨਾ ਅਤੇ ਜਿੱਥੇ ਆਪਣਾ ਸਿਲੰਡਰ ਪਿਆ ਹੈਗਾ ਨਾ ਉੱਥੇ ਮਤਲਬ ਕਿ ਲੱਕੜ ਵਾਲਾ ਸਮਾਨ ਨਹੀਂ ਹੋਣਾ ਚਾਹੀਦਾ ਹੈਗਾ ਜਲਨਸ਼ੀਲ ਆ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਵੀ ਇਹ ਜਿਹੜੀ ਰਸੋਈ ਆ ਆਪਣੀ ਹੈ ਨਾ ਵੀ ਉਹ ਇੱਟੀ ਅਤੇ ਜਿਹੜੇ ਆ ਇੱਟਾਂ ਅਤੇ ਮਿੱਟੀ ਦੀ ਹੋਵੇ ਤਾ ਤਾਂ ਜ਼ਿਆਦਾ ਬਿਹਤਰ ਹੈਗੀ ਅਤੇ ਬਾਕੀ ਜਿਹੜੀਆਂ ਸਾਨੂੰ ਜਿਹੜਾ ਗੈਸ ਸਟੋਵ ਆ ਹੈ ਨਾ ਜਿਹੜਾ ਆਪਣਾ ਇਹ ਸਿਲੰਡਰ ਆ ਉਹਨੂੰ ਚਬੂਤਰੇ ਤੋਂ ਮਤਲਬ ਕਿ ਇਹੋ ਜਿਹੀ ਥਾਂ 'ਤੇ ਰੱਖੋ ਜਿੱਥੇ ਮਤਲਬ ਬਾਹਲੀ ਹਵਾ ਵੀ ਨਾ ਜਾਂਦੀ ਹੋਵੇ ਅਤੇ ਸਿਲੰਡਰ ਅਤੇ ਜਿਹੜਾ ਜਿਹੜਾ ਗੈਸ ਸਟੋਵ ਆ ਨਾ ਇਹਦਾ ਮਤਲਬ ਕਿ ਵਿੱਥ ਹੋਣੀ ਚਾਹੀਦੀ ਹੈਗੀ ਹੈ ਨਾ ਘੱਟੋ ਘੱਟ ਛੇ ਕੁ ਇੰਚ ਛੇ ਸੱਤ ਇੰਚ ਦਾ ਫ਼ਰਕ ਤਾਂ ਹੋਣਾ ਚਾਹੀਦਾ ਹੈਗਾ ਅਤੇ ਬਾਕੀ ਜਿਹੜਾ ਗੈਸ ਜਿਹੜਾ ਸਿਲੰਡਰ ਹੈਗਾ ਉਹਨੂੰ ਆਪਾਂ ਬਾਰੀ ਦੇ ਅੱਗੇ ਨਾ ਰੱਖੋ ਕਿਉਂਕਿ ਹਵਾ ਨਾਲ ਕੀ ਹੈਗਾ ਵੀ ਅੱਗ ਕੀ ਹੈ ਬਲਣ ਦਾ ਜਿਹੜਾ ਖ਼ਤਰਾ ਹੁੰਦਾ ਗਾ ਬਾਕੀ ਜੇ ਜ਼ਿਆਦਾ ਸਮੱਸਿਆ ਵੱਧਦੀ ਆ ਤਾਂ ਆਪਾਂ ਨੂੰ ਇੱਕ ਸਰਕਾਰ ਵੱਲੋਂ ਨੰਬਰ ਦਿੱਤਾ ਹੋਇਆ ਗਾ ਉੱਨੀ ਸੌ ਛੇ ਨੰਬਰ ਇਹਦੇ 'ਤੇ ਆਪਾਂ ਗੱਲ ਕਰ ਸਕਦੇ ਹੈਗੇ ਅਤੇ ਜੇ ਆਪਣੇ ਇਹਦੇ ਨਾਲ ਨਹੀਂ ਮਤਲਬ ਕਿ ਹਾਲਾਤ ਕਾਬੂ 'ਚ ਆਉਂਦੇ ਗੇ ਤਾਂ ਉਹ ਇਹ ਹੀ ਜਿਹੜੀਆਂ ਸੀਗੀਆਂ ਗੱਲਾਂ ਸੀਗੀਆਂ ਜਿਹੜੀ ਆਪਾਂ ਨੂੰ ਧਿਆਨ ਰੱਖਣੀਆਂ ਚਾਹੀਦੀਆਂ ਨੇ